ਅੱਜ ਕੱਲ੍ਹ ਤਾਂ ਬੱਚੇ ਵੀ ਸਾਡੇ ਰਾਸ਼ਟਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਫੋਨ ਰਾਹੀਂ ਹੀ ਦੇ ਦਿੰਦੇ ਹਨ ਟੈਕਨੋਲਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਔਨਲਾਈਨ ਹੀ ਸਾਰੇ ਇਗਜ਼ਾਮ ਹੋ ਜਾਂਦੇ ਹਨ ਜਿੰਨੀ ਵੀ ਸਾਰੀ ਪ੍ਰੀਖਿਆਵਾਂ ਹਨ ਉਹ ਗੂਗਲ ਫੋਮ ਰਾਹੀਂ ਟੈਕਨੋਲਜੀ ਦੇ ਥਰੂ ਬੱਚੇ ਘਰ ਬੈਠ ਕੇ ਵੀ ਦੇ ਸਕਦੇ ਹਨ ਅਤੇ ਕਿਥੇ ਜਾ ਕੇ ਵੀ ਜੇ ਦੇਣਾ ਪੈ ਜਾਂਦਾ ਹੈ ਤਾਂ ਵੀ ਉੱਥੇ ਕੰਪਿਊਟਰ ਲੱਗੇ ਹੁੰਦੇ ਹਨ